ਭੰਗੜੇ ਦੇ ਆਮ ਸਟੈਪ ਫੁਲਕਾ ਪਟਾਕਾ ਮੋਰਚਾਲ ਪੰਜਾਬੀ ਅਤੇ ਤਾੜੀ ਹੈ ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚ ਵਿੱਚੋਂ ਇੱਕ ਹੈ ਦੂਜੇ ਮੁੱਖ ਨਾਚ ਸ ਗਿੱਧਾ ਹੈ ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ ਭੰਗੜਾ ਤਕਰੀਬਨ ਹਰ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਜਿਹਨਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ ਵਿਆਹ ਮੰਗਣੇ ਅਤੇ ਤਿਉਹਾਰ ਆਦਿ ਸ਼ਾਮਿਲ ਹਨ ਇਹ ਲੋਕ ਨਾਚ ਪੰਜਾਬ ਦੀ ਕਿਸਾਨੀ ਸੰਗਰਿਤ ਜਿਹਨਾਂ ਦੀ ਪ੍ਰਾਚਿਤ ਹੈ ਲੋਕ ਧਾਰਾ ਵਿਗਿਆਨਕੀ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ ਪਹਿਲਾਂ ਪਹਿਲਾਂ ਜਦੋਂ ਪੰਜਾਬੀਆਂ ਦੇ ਹਰ ਫਸਲ ਨੂੰ ਸੁਨਹਿਰੀ ਚਿੱਟੇ ਸੁਨਹਿਰੀ ਚਿੱਟੇ ਪੈਂਦੇ ਵੇਖ ਕੇ ਉਹਨਾਂ ਦਾ ਭੁਲਾਰਾ ਆਜ ਕੇ ਨੱਚਦੇ ਖਲੋਤੇ ਲੰਮੇ ਦੇ ਕਈ ਮਿਹਨਤ ਦੀ ਸੁਨਹਿਰੀ ਫਲ ਲੱਗਿਆ ਵੇਖ ਕੇ ਕਿਸੇ ਦਾ ਦਿਲ ਨਹੀਂ ਨੱਚਦਾ